ਸਤਿ ਸ਼੍ਰੀ ਅਕਾਲ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਸੁਰੱਖਿਅਤ ਵਿਅਕਤੀ ਚੰਗੇ ਵਿਹਾਰ ਵੀਤੇ ਸਿਧਾਂਤਾਂ ਦੀ ਪਾਲਣ ਕਰਦਾ ਹੈ ਤਾਂ ਇਹਦੇ ਬਾਰੇ ਮਹਿ ਮੇਰੇ ਦੋ ਰਾਏ ਹੋਣਗੇ ਕੀ ਕਰਦਾ ਵੀ ਹੈ ਅਤੇ ਹੈ ਕੇ ਨਹੀਂ ਵੀ ਕਰਦਾ ਕਿਉਂਕਿ ਆਪਾਂ ਆਮ ਤੌਰ 'ਤੇ ਦੇਖਿਆ ਕੀ ਕੁਝ ਲੋਕ ਪੜ੍ਹ ਲਿਖ ਲੈਂਦੇ ਨੇ ਜ਼ਿਆਦਾ ਤੇ ਉਹਨਾਂ ਨੂੰ ਹੰਕਾਰ ਹੋ ਜਾਂਦਾ ਜਿਵੇਂ ਕਿ ਉਹਨਾਂ ਨੂੰ ਆਪਣੀ ਕਾਬਲੀਅਤ 'ਤੇ ਹੰਕਾਰ ਹੋ ਜਾਂਦਾ ਜੋ ਕਿ ਗਲਤ ਕਿ ਜੇਕਰ ਆਮ ਅਤੇ ਚੰਗਾ ਸਖਸ਼ੀਅਤ ਤੇ ਵਿਅਕਤੀ ਹੋਵੇਗਾ ਤਾਂ ਉਹਨੂੰ ਆਪਣੇ ਉੱਪਰ ਹੰਕਾਰ ਨਹੀਂ ਹੋਵੇਗਾ ਜੋ ਵੀ ਉਹਦੇ ਕੋਲ ਸਿੱਖਿਆ ਹੋਵੇਗੀ ਉਹ ਉਹ ਉਸ ਨੂੰ ਉਹਨੂੰ ਆਪਣੇ ਦੇਸ਼ ਦੀ ਭਲਾਈ ਲਈ ਵਰਤੇਗਾ ਲੋਕਾਂ ਦੀ ਮਦਦ ਕਰੇਗਾ ਉਹਦੇ ਨਾਲ ਕੀ ਕਹੀ ਕੀ ਉਸ ਉੱਤੇ ਹੰਕਾਰ ਕਰੇਗਾ ਤੇ ਜੇਕਰ ਇਹ ਗੱਲ ਹੈ ਤਾਂ ਕੀ ਸਖਸ਼ੀਅਤ ਵਿਅਕਤੀ ਨੂੰ ਆਪਾਂ ਕਿਸੇ ਹਿਸਾਬ ਨਾਲ ਜੱਜ ਨਹੀਂ ਕਰ ਸਕਦੇ ਕਿ ਉਹ ਹੰਕਾਰੀ ਹੰਕਾਰੀ ਹੈ ਜਾਂ ਮਤਲਬ ਕਹਿ ਸਕਦੇ ਹਾਂ ਆਹ ਸਿਧਾਂਤਾਂ ਦੀ ਪਾਲਣਾ ਕਰ ਰਿਹਾ ਹੈ ਕੀ ਉਹ ਉਹਦੇ ਇਸ ਸੁਭਾਅ 'ਤੇ ਨਿਰਭਰ ਕਰਦਾ ਹੈ ਜਿਸ ਹਿਸਾਬ ਨਾਲ ਕੰਮ ਕਰ ਰਿਹਾ ਐ ਉਹ ਉਸ ਉੱਤੇ ਨਿਰਭਰ ਕਰਦਾ ਹੈ ਉਹਨੂੰ ਵੀ ਦੇਖਣਾ ਪੈਂਦਾ ਕਿ ਆਪਣੀ ਜ਼ਿੰਦਗੀ ਵਿੱਚ ਜ਼ਿਆਦਾਤਰ ਇਹ ਦੇਖਿਆ ਤਾਂ ਵੀ ਕਿ ਸਿਖਿਅਤ ਵਿਅਕਤੀ ਜੋ ਹੈ ਉਹ ਸਿਧਾਂਤਾ ਦੀ ਪਾਲਣਾ ਕਰ ਰਿਹਾ ਹੈ ਕਿਉਂਕਿ ਮੈਂ ਅਜਿਹੇ ਲੋਕ ਨੂੰ ਹਜੇ ਤੱਕ ਨਹੀਂ ਮਿਲਿਆ ਕਿ ਜਿਹੜਾ ਨਹੀਂ ਕਰਦਾ ਲੇਕਿਨ ਮੈਂ ਸੁਣਿਆ ਵਾ ਕਿ ਕਈ ਲੋਕ ਹੁੰਦੇ ਨੇ ਜੋ ਨਹੀਂ ਕਰਦੇ ਨੇ ਲੇਕਿਨ ਲੇਕਿਨ ਮੈਂ ਆਪਣੀ ਜ਼ਿੰਦਗੀ ਵਿੱਚ ਸਿਖਿਅਤ ਵਿਅਕਤੀਆਂ ਨੂੰ ਸਿਧਾਂਤਾਂ ਦੀ ਪਾਲਣਾ ਕਰਦੇ ਦੇਖਿਆ ਤਾਂ ਵੱਡਿਆਂ ਦੀ ਆਦਰ ਸਤਿਕਾਰ ਕਰਦਾ ਛੋਟਿਆਂ ਨੂੰ ਵੀ ਜੋ ਕਹਿ ਜੀ ਕਹਿ ਕੇ ਬੁਲਾਉਂਦਾ ਹਾਂ ਆਪਣਾ ਨਿਤਨੇਮ ਵਧੀਆ ਤਰੀਕੇ ਨਾਲ ਕਰਦਾ ਹਾਂ ਪੜ੍ਹਾਈ ਪੜ੍ਹਾਈ ਵਿੱਚ ਵੀ ਵਧੀਆ ਹੁੰਦਾ ਹੈ ਅਤੇ ਹੋਰ ਵੀ ਕੰਮ ਵਧੀਆ ਕਰਦਾ ਹਾਂ ਧੰਨਵਾਦ ਜੀ